ਪੰਜਾਬ ਵਿੱਚ ਕਈ ਤਰ੍ਹਾਂ ਦੇ ਮੁੱਖ ਜੰਗਲੀ ਜਾਨਵਰ ਪਾਏ ਜਾਂਦੇ ਹਨ ਜਿਨ੍ਹਾਂ ਦਾ ਰਿਹ ਜਿਨ੍ਹਾਂ ਦੀ ਰਿਹਾਇਸ਼ ਵਾਸਤੇ ਛੱਤਬੀੜ ਆਦਿ ਤਿਆਰ ਕੀਤੇ ਗਏ ਹਨ ਜਿਹਦੇ ਵਿੱਚ ਕਈ ਪ੍ਰਕਾਰ ਦੇ ਜੰਗਲੀ ਜਾਨਵਰਾਂ ਨੂੰ ਅਤੇ ਵਿਦੇਸ਼ੀ ਜਾਨਵਰਾਂ ਨੂੰ ਵੀ ਰੱਖਿਆ ਜਾਂਦਾ ਹੈ ਇਹ ਸਰਕਾਰ ਵੱਲੋਂ ਮੋਤੀ ਬਾਗ ਹਰੀਕੇ ਪੱਤਣ ਨੈਸ਼ਨਲ ਵੈਲ ਵੈਲਲੈਂਡ ਐਂਡ ਵਾਈਟਲਾਈਫ ਸੈਂਟਰੀ ਸਤਲੁਜ ਵਾਟਰ ਬੋ ਬੋਡੀ ਵਟਲੈਂਡ ਵੀਰ ਮੋਤੀ ਬਾਗ ਆਦਿ ਵਿਚ ਇਹਨਾਂ ਨੂੰ ਰੱਖਿਆ ਗਿਆ ਹੈ ਜੋ ਕਿ ਦੇਖਣ ਦਾ ਵੀ ਇੱਕ ਬਹੁਤ ਵਧੀਆ ਬਣ ਜਾਂਦਾ ਹੈ ਜਿਹਦੇ ਵਿੱਚ ਬੱਚੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਇਹਨਾਂ ਜੰਗਲੀ ਜਾਨਵਰਾਂ ਬਾਰੇ ਪਕਸ਼ੀਆਂ ਬਾਰੇ ਹਾਥੀ ਘੋੜਿਆਂ ਬਾਰੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਰਾਸ਼ਟਰੀ ਪਾਰਕ ਦੇ ਵਿੱਚ ਇਹ ਰਾਸ਼ਟਰੀ ਪਾਰਕ ਹੀ ਬਣਦੇ ਹਨ ਜੋ ਕਿ ਸਰਕਾਰ ਦੁਆਰਾ ਬਣਾਏ ਜਾਂਦੇ ਹਨ ਕਈ ਜੰਗਲੀ ਜਾਨਵਰ ਜੋ ਕਿ ਲੁਪਤ ਹੁੰਦੇ ਜਾ ਰਹੇ ਹਨ ਉਹਨਾਂ ਦੀ ਸਾਂਭ ਸੰਭਾਲ ਲਈ ਇਹਨਾਂ ਚੀਜ਼ਾਂ ਦਾ ਯਤਨ ਕੀਤਾ ਗਿਆ ਹੈ ਜੋ ਕਿ ਇਸ ਤਰ੍ਹਾਂ ਦੇ ਛੱਤਬੀੜ ਜੂ ਆਦਿ ਦੇ ਵਿੱਚ ਸੰਭਾਲ ਕੇ ਰੱਖੇ ਜਾ ਸਕਦੇ ਹਨ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਹੁੰਦੇ ਹਨ ਜਿਵੇਂ ਕਿ ਹਿਰਨ ਸ਼ੇਰ ਭਾਲ ਭਾਲੂ ਹਾਥੀ ਘੋੜਾ ਲੂੰਬੜੀ ਸੂਰ ਕਈ ਤਰ੍ਹਾਂ ਦੇ ਸੱਪਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਹੁੰਦੀਆਂ ਹਨ ਚਿੜੀਆਂ ਦੀਆਂ ਤੋਤਿਆਂ ਦੀਆਂ ਬਹੁਤ ਹੀ ਤਰ੍ਹਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਸੰਭਾਲਣ ਵਾਸਤੇ ਉਹਨਾਂ ਨੇ ਇੱਕ ਖਾਸ ਟਰੇਨਰਾਂ ਨੂੰ ਰੱਖਿਆ ਹੁੰਦਾ ਹੈ ਅਤੇ ਖਾਸ ਡਾਕਟਰਾਂ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਨ ਅਤੇ ਇਹਨਾਂ ਦੇ ਖਾਣ ਪੀਣ ਦੀ ਵੀ ਪੂਰੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਉਹਨਾਂ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਕੈਬਨਸ ਬਣਾਏ ਹੁੰਦੇ ਹਨ ਜਿਹਨਾਂ ਵਿੱਚ ਇਹਨਾਂ ਨੂੰ ਆਕਸੀਜਨ ਅਤੇ ਦੀ ਮਾਤਰਾ ਜੇ ਹੈ ਕਿ ਜੰਗਲੀ ਮਾਹੌਲ ਵੀ ਦਿੱਤਾ ਜਾਂਦਾ ਹੈ ਤਾਂ ਕਿ ਜੋ ਇਹ ਲੰਬੇ ਸਮੇਂ ਤੱਕ ਜੀ ਸਕਣ